ਮੇਨ ਦੋ ਫਸਲਾਂ ਹੁੰਦੀਆਂ ਹੈ ਨਾ ਹਾੜ੍ਹੀ ਅਤੇ ਸਾਉਣੀ ਦੀਆਂ ਫਸਲਾਂ ਹੁੰਦੀਆਂ ਹਨ ਸਾਉਣੀ 'ਚ ਮੰਨ ਲਓ ਆ ਜਾਂਦਾ ਜਿਵੇਂ ਨਰਮਾ ਕਪਾਹ ਝੋਨਾ ਦਾਲਾਂ ਜਿਵੇਂ ਮੂੰਗੀ ਮਸਰ ਮਾਂਹ ਅਤੇ ਫਿਰ ਆ ਜਾਂਦੀ ਹੈ ਮੱਕੀ ਚਾਰੇ ਵਾਲੀ ਮੱਕੀ ਪਠੂ ਪਸ਼ੂਆਂ ਨੂੰ ਪਾਉਣ ਵਾਲੀ ਮੱਕੀ ਚਾਰੇ ਲਈ ਅਤੇ ਦਾਣੇ ਵਾਲੀ ਮੱਕੀ ਫੇਰ ਆ ਜਾਂਦੀ ਆ ਹਾੜ੍ਹੀ ਹਾੜ੍ਹੀ 'ਚ ਮੰਨ ਲਓ ਮੇਨ ਹੁੰਦੀ ਆ ਕਣਕ ਸਰੋਂ ਰਾਇਆ ਇਹ ਦੋ ਤਿੰਨ ਫਸਲਾਂ ਹੁੰਦੀਆਂ ਹਨ ਜੋ ਆਪਣੇ ਬੀਜੀਆਂ ਜਾਂਦੀਆਂ ਅਤੇ ਫੇਰ ਇਹ ਅਲੱਗ ਅਲੱਗ ਟਾਈਮ ਹੈ ਇਹਨਾਂ ਦੇ ਬੀਜਣ ਦਾ ਜਿਵੇਂ ਕਿ ਝੋਨੇ ਦਾ ਹੁਣ ਫੱਕ ਬੀਜਣ ਦਾ ਟਾਈਮ ਹੈਗਾ ਫੱਕ ਪਨੀਰੀ ਲੱਗ ਰਹੀ ਹੈ ਜਾਂ ਸਿੱਧੀ ਬਿਜਾਈ ਲਈ ਵੀ ਬੀਜਿਆ ਜਾ ਰਿਹਾ ਝੋਨਾ ਮੇਨ ਝੋਨਾ ਲੱਗਣ ਦਾ ਟਾਈਮ ਹੈ ਜੂਨ ਦੇ ਵੀਹ ਤਰੀਕ ਤੋਂ ਹੈ ਫੇਰ ਜੁਲਾਈ ਵੀ ਲੱਗਦਾ ਰਹਿੰਦਾ ਅਗਸਤ ਵੀ ਜਿਹੜਾ ਬਾਸਮਤੀ ਝੋਨਾ ਗਾ ਇਹ ਲੱਗਦਾ ਸਾਉਣ ਮਹੀਨੇ 'ਚ ਜਾ ਕੇ ਇਹ ਉਦੋਂ ਲੱਗਦਾ ਗਾ ਫੇਰ ਆ ਜਾਂਦੀ ਹੈ ਹਾੜ੍ਹੀ ਦੀਆਂ ਫਸਲਾਂ ਹਾੜ੍ਹੀ ਦੀਆਂ ਫਸਲਾਂ 'ਚ ਮੇਨ ਆਪਣਾ ਕਣਕ ਅਤੇ ਸਰ੍ਹੋਂ ਇਹ ਹੁੰਦੀ ਹੈ ਜਿਹੜੀ ਸਰ੍ਹੋਂ ਹੈਗੀ ਇਹ ਬੀਜੀ ਜਾਂਦੀ ਹੈ ਸਤੰਬਰ ਦੇ ਲਾਸਟ ਅਤੇ ਅਕਤੂਬਰ ਦਾ ਸਾਰਾ ਮਹੀਨਾ ਸਹੀ ਮ ਸਮਾਂ ਇਹ ਹੈ ਜਿਹੜੀ ਹੈਗੀ ਹੈ ਕਣਕ ਕਣਕ ਬੀਜੀ ਜਾਂਦੀ ਹੈ ਅਕਤੂਬਰ ਦੇ ਲਾਸਟ ਹਫਤੇ ਤੋਂ ਸ਼ੁਰੂ ਹੋ ਕੇ ਸਾਰਾ ਨਵੰਬਰ ਜੇ ਆਪਾਂ ਉਸ ਤੋਂ ਲੇਟ ਬੀਜਦੇ ਹਾਂ ਤਾਂ ਫੇਰ ਇਸਦਾ ਝਾੜ 'ਤੇ ਅਸਰ ਪੈਂਦਾ ਗਾ ਜਿਵੇਂ ਜਿੰਨੇ ਹਫਤੇ ਜਿੰਨੇ ਆਪਾਂ ਦਿਨ ਲੇਟ ਹੋਈ ਜਾਂਦੇ ਉਵੇਂ ਉਵੇਂ ਇਹਦਾ ਝਾੜ ਘੱਟਦਾ ਰਹਿੰਦਾ ਗਾ ਐਦਾਂ ਕਰਕੇ ਇਹ ਚੀਜ਼ਾਂ ਦੇਖਿਆ ਉੱਦਾਂ ਐਵੇਂ ਹੀ ਸਬਜ਼ੀਆਂ ਦਾ ਹੁੰਦਾ ਸਬਜ਼ੀ ਜਿਵੇਂ ਹੁਣ ਆਪਾਂ ਬੀਜ ਰਹੇ ਹਾਂ ਕੱਦੂ ਤੋਰੀ ਭਿੰਡੀ ਗਵਾਰਾ ਇਹਨਾਂ ਦਾ ਟਾਈਮ ਹੈਗਾ ਜਿਹੜੀ ਹਾੜ੍ਹੀ ਦੀਆਂ ਸਬਜ਼ੀਆਂ ਹੁੰਦੀਆਂ ਨਾ ਉਹ ਅਕਤੂਬਰ ਨਵੰਬਰ ਦਸੰਬਰ ਜਨਵਰੀ ਗਾਜਰਾਂ ਬੀਜ ਦਿੰਦੇ ਮੂਲੀਆਂ ਸ਼ਲਗਮ ਇਹ ਸਾਰੀਆਂ ਫਸਲਾਂ ਉਦੋਂ ਬੀਜੀਆਂ ਜਾਂਦੀਆਂ ਰੇਹਾਂ ਸਪਰੇਆਂ ਦਾ ਕਾਫੀ ਅਸਰ ਹੈਗਾ ਫਸਲਾਂ 'ਤੇ ਇਹਦਾ ਹੁੰਦਾ ਵੀ ਹੈ ਵੀ ਕਰਨੀਆਂ ਵੀ ਪੈਂਦੀਆਂ ਇਹ ਰੇਹਾਂ ਸਪਰੇਅ ਤਾਂ ਅਤੇ ਔਰਗੈਨਿਕ ਵੀ ਵਿੱਚ ਬਹੁਤ ਲੋਕ ਕਰ ਰਹੇ ਹੈ ਅਤੇ ਔ ਔਰਗੈਨਿਕ ਉਤਸ਼ਾਹਿਤ ਕਰਨੀ ਵੀ ਚਾਹੀਦੀ ਹੈ ਸਰਕਾਰਾਂ ਨੂੰ ਵੀ ਚਾਹੀਦਾ ਲੋਕਾਂ ਨੂੰ ਵੀ ਚਾਹੀਦਾ ਜਾਗਰੂਕ ਹੋਣ ਅਤੇ ਔਰਗੈਨਿਕ ਖੇਤੀ ਕਰਨ ਸਬਜ਼ੀ ਤਾਂ ਘੱਟੋ ਘੱਟ ਕਰਨ ਚਾਹੇ ਆਪਦੇ ਖਾਣ ਲਈ ਕਣਕ ਤਾਂ ਬੀਜਣ